ਹਾਂਜੀ ਮੈਂ ਪ੍ਰਦਰਸ਼ਨੀ ਦਾ ਕ ਕਲਾ ਪ੍ਰਦਰਸ਼ਨੀ ਦਾ ਮੈਂ ਦੌਰਾ ਕੀਤਾ ਹੈ ਕਿਉਂਕਿ 'ਚ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਅਨੁਭਵ ਹੁੰਦਾ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕਲਾ ਕ੍ਰਿਤੀ ਮੈਨੂੰ ਮਨਮੋਹ ਕਰਦੀਆਂ ਹਨ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਜ਼ਿਆਦੇ ਵਧੀਆ ਲੱਗਦਾ ਹੈ